ਸੋ ਮੇਰੇ ਪਿੰਡ ਤਰਨਤਾਰਨ ਵਿੱਚ ਕਈ ਤਰ੍ਹਾਂ ਦੇ ਬਿਜ਼ਨਸ ਕੀਤੇ ਜਾਂਦੇ ਹਨ ਜਿਵੇਂ ਕਿ ਕਈ ਲੋਕਾਂ ਦਾ ਆਪਣਾ ਪੋਲਟਰੀ ਫਾਰਮ ਹੈ ਕਈ ਲੋਕਾਂ ਦੀਆਂ ਸ਼ੋਪਸ ਹਨ ਜਿਵੇਂ ਕਿ ਕੋਈ ਕੱਪੜਿਆਂ ਦਾ ਕੰਮ ਕਰਦਾ ਹੈ ਕੋਈ ਹਲਵਾਈ ਹੈ ਕੋਈ ਵੀਡੀਓ ਮਿਕਸਿੰਗ ਦਾ ਕੰਮ ਕਰਦਾ ਹੈ ਕਿਸੇ ਦੇ ਕਰਿਆਨਾ ਸਟੋਰ ਨੇ ਕਿਸੇ ਦੇ ਬੁੱਕ ਸਟੋਰ ਨੇ ਅਤੇ ਕਿਸੇ ਦੀਆਂ ਸ਼ੂਜ਼ ਦੀਆਂ ਸ਼ੋਪਸ ਹਨ ਇਸ ਤਰ੍ਹਾਂ ਮੇਰੇ ਪਿੰਡ ਤਰਨਤਾਰਨ ਵਿੱਚ ਕਈ ਤਰ੍ਹਾਂ ਦੇ ਬਿਜ਼ਨਸ ਕੀਤੇ ਜਾਂਦੇ ਆ ਅੱਜ ਕੱਲ੍ਹ ਤਾਂ ਲੋਕ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਕਈ ਸੋਸ਼ਲ ਐਪਸ ਦੀ ਵੀ ਵਰਤੋਂ ਕਰਦੇ ਹਨ ਜਿਵੇਂ ਕਿ ਇੰਸਟਾਗ੍ਰਾਮ ਯੂਟਿਊਬ ਇੰਸਟਾਗ੍ਰਾਮ ਉੱਤੇ ਲੋਕ ਆਪਣੀਆਂ ਰੀਲਸ ਪਾਉਂਦੇ ਹਨ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਦੇ ਹਨ ਅਤੇ ਉਹਨਾਂ ਨੂੰ ਕਾਫ਼ੀ ਇਸ ਵਿੱਚ ਬੱਚਤ ਵੀ ਹੁੰਦੀ ਹੈ ਲੋਕਾਂ ਨੂੰ ਦੂਰੋਂ ਦੂਰੋਂ ਤੋਂ ਔਡਰ ਆਉਂਦੇ ਇਸ ਪ੍ਰਕਾਰ ਯੂਟਿਊਬ 'ਤੇ ਲੋਕ ਸ਼ੋਰਟਸ ਵੀ ਬਣਾਉਂਦੇ ਹਨ ਜਿਵੇਂ ਕਿ ਕਿਸੇ ਦੇ ਕੱਪੜੇ ਦੀ ਦੁਕਾਨ ਹੈ ਤਾਂ ਉਹ ਆਪਣੇ ਕੱਪੜਿਆਂ ਦੀ ਪ੍ਰਮੋਸ਼ਨ ਕਰਨ ਲਈ ਰੀਲਸ ਬਣਾਏਗਾ ਜਾਂ ਵੀਡੀਓਸ ਅਪਲੋਡ ਕਰੇਗਾ ਇਸ ਤਰ੍ਹਾਂ ਦੂਰੋਂ ਦੂਰੋਂ ਉਹਨਾਂ ਨੂੰ ਔਡਰ ਆਉਂਦੇ ਹਨ ਅਤੇ ਇਸ ਤਰ੍ਹਾਂ ਉਹਨਾਂ ਦਾ ਬਹੁਤ ਹੀ ਫ਼ਾਇਦਾ ਹੁੰਦਾ ਹੈ